ਬ੍ਰਿੰਦਾਵਨ ਜਾਣ ਵਾਸਤੇ ਕਿਹੜੀ ਰੇਲ ਗੱਡੀ ਸਮੇਂ ਸਿਰ ਮਿਲ ਜਾਵੇਗੀ ਉਹਦੇ ਆਉਣ ਦਾ ਸਮਾਂ ਕੀ ਹੈ ਰਵਾਨਗੀ ਦਾ ਸਮਾਂ ਕੀ ਹੈ ਅਤੇ ਪਹੁੰਚਣ ਦਾ ਸਮਾਂ ਕੀ ਹੈ ਅਤੇ ਉਹਦੇ ਵਿੱਚ ਕਿਹੜੇ ਕਿਹੜੇ ਸਟੇਸ਼ਨ ਆਉਂਦੇ ਨੇ ਬ੍ਰਿੰਦਾਵਨ ਜਾਣ ਵਾਸਤੇ ਅਸੀਂ ਪੰਜਾਬ ਮੇਲ ਦੀ ਬੁਕਿੰਗ ਕਰਵਾਵਾਂਗੇ ਉਹ ਫਿਰੋਜ਼ਪੁਰ ਤੋਂ ਰਾਤੀਂ ਪੌਣੇ ਦਸ ਚੱਲਦੀ ਹੈ ਅਤੇ ਸਵੇਰੇ ਸੱਤ ਵਜੇ ਮਥੁਰਾ ਸਟੇਸ਼ਨ 'ਤੇ ਪਹੁੰਚ ਜਾਂਦੀ ਹੈ